ਇਸ ਦੁਨੀਆਂ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟਿੰਗ ਚੀਜ਼ਾਂ ਹਨ ਬਟ ਮੈਨੂੰ ਆਪਣੀ ਅਪਣੀ ਧਰਤੀ ਅਤੇ ਆਪਣੇ ਅੰਤਰਿਕਸ਼ ਬਾਰੇ ਜਾਣਨਾ ਬਹੁਤ ਜ਼ਿਆਦਾ ਪਸੰਦ ਹੈ ਜਿਵੇਂ ਕਿ ਸਾਡੀ ਗਲੈਕਸੀ ਮਿਲਕੀ ਵੇਅ ਗਲੈਕਸੀ ਦਾ ਨਾਮ ਦਿੱਤਾ ਗਿਆ ਹੈ ਇਹ ਇੱਕ ਗਲੈਕਸੀ ਹੈ ਜਿਸ ਦੇ ਵਿੱਚ ਅਣਗਿਣਤ ਤਾਰੇ ਹਨ ਅਤੇੇ ਏ ਅਤੇ ਅਠ ਅੱਠ ਪਲੈਨਟ ਹਨ ਜਿਸਦੇ ਵਿੱਚ ਕਿ ਇੱਕ ਸੂਰਜ ਵੀ ਹੈ ਅਤੇ ਆਪਣੇ ਪਲੈਨਟਾਂ ਦਾ ਨਾਮ ਮਰਕਰੀ ਵੀਨਸ ਅਰਥ ਮਾਰ ਜੁਪੀਟਰ ਸੈਟਰਨ ਯੂਰੇਨਸ ਨੈਪਟਿਊਨ ਇਹ ਜਿਹੜੇ ਅੱਠ ਪਲੈਨਟ ਵੀ ਹਨ ਬਲਕੀ ਇੱਕ ਨੋਵਾਂ ਪਲੈਨਟ ਜਿਸਦਾ ਨਾਮ ਪਲੂਟੋ ਵੀ ਹੈ ਪਰ ਉਹ ਪਲੈਨਟ ਦੀ ਸ਼੍ਰੇਣੀ ਦੇ ਵਿੱਚ ਨਹੀਂ ਆਉਂਦਾ ਕਿਉਂਕਿ ਉਸਦਾ ਸਾਈਜ਼ ਇੱਕ ਨੋਰਮਲ ਪਲੈਨਟ ਤੋਂ ਬਹੁਤ ਜ਼ਿਆਦਾ ਛੋਟਾ ਹੈ ਬਟ ਇਸ ਦੇ ਇਸ ਗਲੈਕਸੀ ਦੇ ਵਿੱਚ ਅਣਗਿਣਤ ਤਾਰੇ ਵੀ ਹਨ ਅਤੇ ਇੱਕ ਤਾਰਾ ਜਦੋਂ ਇੱਕ ਫੁੱਟ ਦਾ ਹੈ ਅਤੇ ਉਹ ਬਲੈਕ ਹੋਲ ਬਣ ਜਾਂਦਾ ਹੈ ਇੱਕ ਬਲੈਕ ਹੋਲ ਐਸਾ ਐਸੀ ਜਗ੍ਹਾ ਹੈ ਜਿਸ ਦੇ ਵਿੱਚ ਲਾਈਟ ਵੀ ਨਹੀਂ ਪਾਸ ਹੋ ਪਾਉਂਦੀ ਅਤੇ ਇਸ ਦੇ ਵਿੱਚ ਕੀ ਹੈ ਇੱਕ ਅਗਰ ਕੋਈ ਮਨਸਾ ਕੋਈ ਚੀਜ਼ ਕਹਿ ਲਉ ਫਸ ਜਾਵੇ ਤਾਂ ਉਹ ਅਨੰਤ ਕਾਲ ਦੇ ਵਿੱਚ ਅਨੰਤ ਕਾਲ ਦੇ ਲਈ ਉਸਦੇ ਵਿੱਚ ਫਸੀ ਰਹਿ ਜਾਂਦੀ ਹੈ ਅਤੇ ਇਸ ਦੇ ਵਿ ਇਸ ਦੀ ਸਟਡੀ ਬਹੁਤ ਸਾਰਾ ਇਸ ਬਹੁਤ ਸਾਰੇ ਅਮਰੀਕਾ ਦੇ ਵਿੱਚ ਸਟੈਨ ਸਾਇੰਟਿਸਟ ਹਨ ਜਿਸਦੀ ਇਹ ਸਟਡੀ ਕਰ ਰਹੇ ਹਨ ਅਤੇ ਹੌਲੀ ਹੌਲੀ ਇਸਦੇ ਬਾਰੇ ਹੋਰ ਗਹਿਰਿਆ ਗਹਿਰਾਈ ਦੇ ਨਾਲ ਪਤਾ ਲੱਗ ਰਿਹਾ ਹੈ ਅਤੇ ਅਰਥ ਦੇ ਸਭ ਤੋਂ ਨੀਅਰੈਸਟ ਪਲੈਨਟ ਮਾਰਸ ਦੇ ਵਿੱਚ ਕਹਿੰਦੇ ਜਾ ਕਿਹਾ ਜਾਂਦਾ ਹੈ ਕਿ ਮਾਰਸ ਦੇ ਵਿੱਚ ਪਹਿਲਾਂ ਵਹੁ ਲਾਈਵ ਬਣ ਕਾਫੀ ਹਜ਼ਾਰਾਂ ਸਾਲਾਂ ਪਹਿਲਾਂ ਲਾਈਫ ਵੀ ਸੀਗੀ ਬਟ ਉੱਥੇ ਦੇ ਐਟਮੋਸਫੇਅਰ ਦੇ ਕਾਰਨ ਉਹ ਲਾਈਫ ਖਤਮ ਹੋ ਚੁੱਕੀ ਹੈ ਅਤੇ ਅੱਜ ਦੇ ਸਮੇਂ ਦੇ ਵਿੱਚ ਸਾਡੇ ਸਾਇੰਟਿਸਟ ਉੱਥੇ ਆਪਣੇ ਲੋਕਾਂ ਆਪਣੇ ਯੰਤਰ ਭੇਜ ਕੇ ਜਿਵੇਂ ਭਾਰਤ ਵੀ ਆਪਣਾ ਮੰਗਲਯਾਨ ਭੇਜਿਆ ਸੀਗਾ ਦੋ ਹਜ਼ਾਰ ਉੱਨੀ ਦੇ ਵਿੱਚ ਉੱਥੇ ਦੀ ਰ ਮਿੱਟੀ ਬਾਰੇ ਉੱਥੇ ਦੀ ਦ੍ਰਿਸ਼ ਬਾਰੇ ਪਤਾ ਕਰਨ ਦੇ ਨਾਲ ਦੇ ਲਈ ਅਤੇ ਉੱਥੇ ਦੇ ਰੋਵਰ ਨੇ ਪਤਾ ਲਗਾਇਆ ਕਿ ਉੱਥੇ ਤਾਂ ਲਾਈ ਜ਼ਿੰਦਗੀ ਪੋਸੀਬਲ ਹੈਗੀ ਹੈ ਕਿਉਂਕਿ ਉੱਥੇ ਪਾਣੀ ਦੀ ਵੀ ਪਾਣੀ ਵੀ ਪਾਇਆ ਗਿਆ ਹੈ ਜਿਵੇਂ ਆਪਣਾ ਚੰਦ ਵੀ ਹੈ ਚੰਦ ਦੇ ਉੱਤੇ ਵੀ ਪਾਣੀ ਪਾਇਆ ਗਿਆ ਹੈ ਅਤੇ ਉੱਥੇ ਅਮਰੀਕਾ ਨੇ ਆਪਣੇ ਐਸਟਰਾਨੋਡ ਜਿਵੇਂ ਕਿ ਨੀਲ ਆਮਸਟਰੌਂਗ ਨੂੰ ਵੀ ਭੇਜਿਆ ਹੈ ਅਤੇ ਉੱਥੇ ਜਾ ਕੇ ਉਹਨਾਂ ਨੇ ਰਿਸਰਚ 'ਤੇ ਦਾਅਵਾ ਕਰਿਆ ਹੈ ਕਿ ਚੰਦ 'ਤੇ ਵੀ ਲਾਈਫ ਪੋਸੀਬਲ ਹੈਗੀ ਹੈ ਅਤੇ ਉੱਥੇ ਬ ਇੱਕ ਨੋ ਸਾਊਥ ਪੋਲ ਵੀ ਹੈ ਜਿ ਡਾਰਕ ਸਾਈਡ ਵੀ ਹੈ ਮੂਨ ਦੀ ਜਿੱਥੇ ਅੱਜ ਤੱਕ ਭਾਰਤ ਨੇ ਹਿੰਮਤ ਕਰਕੇ ਆਪਣਾ ਚੰਦਰਯਾਨ ਤਿੰਨ ਭੇਜਿਆ ਜੋ ਕਿ ਇੱਕ ਬੜਾ ਹੀ ਕਾਮਯਾਬ ਰਿਹਾ ਉਹ ਮਿਸ਼ਨ ਰਿਹਾ ਜਿਸਦੇ ਵਿੱਚ ਸਾਡਾ ਰੋਵਰ ਘੁੰਮ ਰਿਹਾ ਹੈ ਅਤੇ ਆਪਣਾ ਚੰਦ ਦੇ ਉੱਤੇ ਇੱਕ ਰੋਵਰ ਘੁੰਮ ਰਿਹਾ ਹੈ ਅਤੇ ਆਪਣੇ ਚੰਦ ਦੀ ਫੋਟੋਆਂ ਵੀ ਸਾਨੂੰ ਭੇਜ ਰਿਹਾ ਹੈ ਅਤੇ ਉੱਥੇ ਦੀਆਂ ਸਾਨੂੰ ਹੋਰ ਵੀ ਚੀਜ਼ਾਂ ਬਾਰੇ ਪਤਾ ਲੱਗ ਰਿਹਾ ਹੈ ਅਤੇ ਇੱਕ ਧਰ ਓ ਸਾਡੀ ਗਲੈਕਸੀ ਇੱਕ ਐਸੀ ਜਗ੍ਹਾ ਹੈ ਜੋ ਕਿ ਪੂਰੇ ਰਾਜ਼ ਰਾਜ਼ ਦੇ ਨਾਲ ਭਰੀ ਹੋਈ ਹੈ ਅਤੇ ਇਸ ਦਾ ਕੋਈ ਅੰਤ ਨਹੀਂ ਹੈ